ਪੰਜਾਬ ਵਿੱਚ ਨਿੱਜੀ ਸਿੱਖਿਆ ਦੇ ਆਪਣਾ ਸਕੂਲਾਂ ਦੇ ਵਿੱਚ ਬੜੀ ਅੱਛੀ ਸ਼ਿਕਸ਼ਾ ਦਿੱਤੀ ਜਾਂਦੀ ਹੈ ਟਿਊਸ਼ਨ ਕਲਾਸਾਂ ਵੀ ਦਿੱਤੀਆਂ ਜਾਂਦੀਆਂ ਹਨ ਕੋਚਿੰਗ ਸੈਂਟਰ ਦੇ ਵਿੱਚ ਵੀ ਬੱਚੇ ਬੜੇ ਅੱਛੀ ਤਰ੍ਹਾਂ ਪੜ੍ਹਾਈ ਕਰ ਲੈਂਦੇ ਹਨ ਪਰ ਉਹਦੇ ਵਿੱਚ ਇਹ ਹੈਗਾ ਵਾ ਕਿ ਇਹਦੇ ਨਾਲ ਪੜ੍ਹ ਲਿਖ ਕੇ ਬੱਚੇ ਅੱਗੇ ਦੇਸ਼ ਦਾ ਬਵਿਸ਼ਯ ਹੀ ਉਜਵਲ ਕਰਨਗੇ ਅਤੇ ਉਹਦੇ ਨਾਲ ਇਹ ਵਾ ਕਿ ਜਿਹੜੇ ਅੱਜ ਕੱਲ੍ਹ ਜਿਹੜੇ ਪੰਚ ਯੋਗਤਾ ਦੇ ਵਿੱਚ ਦੇ ਮਾਮਲੇ ਦੇ ਵਿੱਚ ਇਹ ਵੈ ਕਈਆਂ ਦੀ ਸਿਫਾਰਸ਼ਾਂ ਚੱਲ ਜਾਂਦੀਆਂ ਜਦੋਂ ਬੱਚੇ ਜਿਹੜੇ ਕਿ ਆਪਣਾ ਆਪਣੀ ਮਿਹਨਤ ਦੇ ਨਾਲ ਪੜ੍ਹਾਈ ਕਰਦੇ ਹਨ ਅਤੇ ਉਹ ਤਾਂ ਆਪਣਾ ਪਿੱਛੇ ਰਹਿ ਜਾਂਦੇ ਹਨ ਅਤੇ ਜਿਨ੍ਹਾਂ ਜਿਹੜੇ ਕਿ ਰਿਸ਼ਵਤ ਵਗੈਰਾ ਦੇ ਕੇ ਆਪਣਾ ਪਾਸ ਹੁੰਦੇ ਹਨ ਉਹ ਉਹ ਤਾਂ ਪ ਉਹ ਤਾਂ ਅੱਗੇ ਨਿਕਲ ਜਾਂਦੇ ਬਟ ਜਿਹੜੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਹੁੰਦੀਆਂ ਉਹ ਪਿੱਛੇ ਰਹਿ ਜਾਂਦੇ ਹਨ ਉਹਦੇ ਨਾਲ ਕੀ ਹੁੰਦਾ ਕਿ ਸਰਕਾਰ ਨੂੰ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਜਿਹੜੇ ਬੱਚਿਆਂ ਨੇ ਮਿਹਨਤਾਂ ਕੀਤੀਆਂ ਹਨ ਉਹ ਵੀ ਆਪਣੀ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਆਪਣੀ ਜ਼ਿੰਦਗੀ ਨੂੰ ਸਫਲ ਕਰਨ ਅਤੇ ਆਪਣੇ ਬਵਿਸ਼ਯ ਉਜਵਲ ਕਰਨ ਅਤੇ ਤਾਂ ਕਿ ਸ ਸਰਕਾਰ ਇਹਨਾਂ ਵੱਲ ਧਿਆਨ ਦੇਵੇਗੀ ਤਾਂ ਹੀ ਇਹ ਬੱਚਿਆਂ ਦਾ ਬਵਿੱਸ਼ਯ ਵੀ ਉਜਵਲ ਹੋਏਗਾ ਅਤੇ ਉਹਨਾਂ ਨੂੰ ਉ ਉਹਨਾਂ ਦੇ ਅੱਛੇ ਭਵਿੱਖ ਦੀ ਭਵਿੱਖ ਉਹਨਾਂ ਦਾ ਅੱਛਾ ਹੋ ਚੰਗਾ ਹੋਏਗਾ ਅਤੇ ਉਹਨਾਂ ਦੀ ਜ਼ਿੰਦਗੀ ਵੀ ਚੰਗੀ ਬਣੇਗੀ ਉਹਨਾਂ ਦੇ ਮਾਂ ਪਿਉ ਦੀ ਜ਼ਿੰਦਗੀ ਵੀ ਅੱਛੀ ਬਣੇਗੀ ਅਤੇ ਦੇਸ਼ ਦਾ ਭਵਿੱਖ ਵੀ ਚੰਗਾ ਬਣੇਗਾ ਸਰਕਾਰ ਨੂੰ ਇਸ ਚੀਜ਼ ਦੇ ਬਾਰੇ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਦੀ ਬੱਚਿਆਂ ਦੀ ਸਕੂਲਾਂ ਦੀ ਪੜ੍ਹਾਈ ਤਾਂ ਕਿ ਕਿਤੇ ਵੀ ਬੱਚਿਆਂ ਦੇ ਪੇ ਜਦੋਂ ਉਹਨਾਂ ਦੇ ਪੇਪਰ ਹੁੰਦੇ ਹਨ ਤਾਂ ਕਿਤੇ ਵੀ ਉਹਨਾਂ ਦੀ ਮਤਲਬ ਕਿ ਜਿਹੜਾ ਹੈਗੀ ਹੈ ਉਹਨਾਂ ਦੀ ਸ਼ਿਫ ਉਹਨਾਂ ਦੀ ਅਮੀਰ ਲੋਕਾਂ ਦੀ ਸਿਫਾਰਸ਼ ਨਾ ਚੱਲੇ ਕਿਤੇ ਵੀ